ਵੈਸੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਵੱਛ ਭਾਰਤ ਅਭਿਆਨ ਕੀ ਹੈ ਇਸ ਦਾ ਕਾਫੀ ਸਾਰੇ ਲੋਕਾਂ ਨੂੰ ਫਾਇਦਾ ਹੀ ਹੋਇਆ ਹੈ ਨੁਕਸਾਨ ਦੀ ਤਾਂ ਕੋਈ ਗੱਲ ਹੀ ਨਹੀਂ ਆਉਂਦੀ ਸਵੱਛ ਭਾਰਤ ਅਭਿਆਨ ਦਾ ਮਤਲਬ ਹੈ ਕਿ ਸਾਡਾ ਸਾਫ ਸੁਥਰਾ ਭਾਰਤ ਸਾਫ ਸੁਥਰਾ ਭਾਰਤ ਯਾਨੀ ਕਿ ਸਾਡੇ ਆਲੇ ਦੁਆਲੇ ਸਭ ਸਾਫ ਰਹਿਣਗੇ ਸਾਡੇ ਆਲੇ ਦੁਆਲੇ ਉੱਤੇ ਵੀ ਕਾਫੀ ਜ਼ਿਆਦਾ ਅਸਰ ਪਿਆ ਹੈ ਅਤੇ ਸਾਡੇ ਉੱਤੇ ਵੀ ਕਾਫੀ ਜ਼ਿਆਦਾ ਅਸਰ ਪਿਆ ਹੈ ਸਾਨੂੰ ਜਾਗਰੂਕਤਾ ਮਿਲੀ ਹੈ ਕਿ ਸਾਨੂੰ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣਾ ਚਾਹੀਦਾ ਹੈ ਜਿਹਦੇ ਕਰਕੇ ਕੋਈ ਗੰਦਗੀ ਨਾ ਰਹੇ ਜਾਂ ਕੋਈ ਇਹੋ ਜਿਹੇ ਗੱਲ ਵੀ ਨਾ ਹੋ ਜੇ ਜਿਹਦੇ ਕਰਕੇ ਤੁਹਾਨੂੰ ਬਿਮਾਰੀਆਂ ਵੀ ਸਹਿਣੀਆਂ ਪੈ ਜਾਣ ਕਈ ਵਾਰੀ ਸਵੱਛ ਨਾ ਹੋਣ 'ਤੇ ਇੱਦਾਂ ਵੀ ਹੋਇਆ ਹੈ ਕਿ ਕਾਫੀ ਜ਼ਿਆਦਾ ਮੱਛਰ ਵਗੈਰਾ ਪੈਦਾ ਹੋ ਜਾਂਦੇ ਨੇ ਜਿਹਦੇ ਨਾਲ ਸਾਨੂੰ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਹੈ ਕਾਫੀ ਜ਼ਿਆਦਾ ਲੋਕਾਂ ਨੂੰ ਡੇਂਗੂ ਜਾਂ ਮਲੇਰੀਆ ਵੀ ਹੋ ਗਿਆ ਹੈ ਕਿਉਂਕਿ ਗੰਦਗੀ ਦੇ ਕਾਰਨ ਹੀ ਇਹ ਸਭ ਕੁਛ ਹੋਇਆ ਹੈ ਇਸ ਲਈ ਇਹਨੂੰ ਸਾਫ ਕਰਨ ਲਈ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਅਭਿਆਨ ਚਲਾਇਆ ਸੀ ਸਵੱਛ ਭਾਰਤ ਅਭਿਆਨ ਦੇ ਕਰਕੇ ਕਾਫੀ ਸਾਰੀ ਜਗ੍ਹਾਵਾਂ ਸਾਫ ਹੋ ਗਈਆਂ ਜਿਹੜੀਆਂ ਕਿ ਪਹਿਲੇ ਸਾਫ ਕਦੀ ਨਹੀਂ ਰਹਿੰਦੀਆਂ ਸੀ ਸਾਡੀ ਨਾਲੀਆਂ ਸਾਡੇ ਪਾਈਪਲਾਈਨ ਵਗੈਰਾ ਸਭ ਸਾਫ ਹੋ ਗਏ ਜੋ ਵੀ ਗੰਦਗੀ ਸਾਡੇ ਆਲੇ ਦੁਆਲੇ ਸੀਗੀ ਉਹ ਸਭ ਸਾਫ ਹੋ ਗਈ ਤੁਸੀਂ ਸਾਡੇ ਆਪਣੇ ਸ਼ਹਿਰ ਵੇਖ ਲਓ ਭਾਵੇਂ ਪਿੰਡ ਵੇਖ ਲਓ ਹਰ ਬੰਨੇ ਸਾਫ ਸਫਾਈ ਹੋ ਗਈ ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ ਰਹੀ ਜਿੱਥੇ ਗੰਦਗੀ ਹੋਵੇ ਅੱਜ ਕੱਲ੍ਹ ਹਰ ਕੋਈ ਬੰਦੇ ਧਿਆਨ ਵੀ ਦੇ ਰਹੇ ਨੇ ਕੋਈ ਨਹੀਂ ਵੀ ਦਿੰਦਾ ਪਰ ਇਸਦਾ ਮੇਰੇ 'ਤੇ ਵੀ ਕਾਫੀ ਜ਼ਿਆਦਾ ਅਸਰ ਹੋਇਆ ਹੈ ਮੈਨੂੰ ਇਹ ਗੱਲ ਸਮਝ ਆ ਗਈ ਹੈ ਕਿ ਸਾਫ ਸਫਾਈ ਦੇ ਬਗੈਰ ਅਸੀਂ ਨਹੀਂ ਜੀ ਰਹੇ ਰਹਿ ਸਕਦੇ ਇੱਕ ਸਾਫ ਸੁਥਰੀ ਜ਼ਿੰਦਗੀ ਅਸੀਂ ਨਹੀਂ ਜੀ ਸਕਦੇ ਇਸ ਲਈ ਸਾਫ ਸੁਥਰਾ ਰਹਿਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਧੰਨਵਾਦ